ਹਾਂ ਮੈਨੂੰ ਲਿਖਣਾ ਪਸੰਦ ਹਾਂ ਮੈਨੂੰ ਲਿਖਣਾ ਪਸੰਦ ਹੈ ਜਦੋਂ ਮੈਂ ਇਕੱਲੀ ਹੁੰਦੀ ਹਾਂ ਤਾਂ ਕੁਝ ਨਾ ਕੁਝ ਲਿਖਦੀ ਰਹਿੰਦੀ ਹਾਂ ਮੈਨੂੰ ਲਿਖਦੇ ਸਮੇਂ ਕਈ ਆਦਤਾਂ ਹਨ ਜਿਵੇਂ ਕਿ ਮੈਨੂੰ ਲਿਖਦੇ ਸਮੇਂ ਆਸ ਪਾਸ ਦਾ ਮਾਹੌਲ ਸ਼ਾਂਤ ਚਾਹੀਦਾ ਹੈ ਮੇਰੇ ਆਲੇ ਦੁਆਲੇ ਕੋਈ ਵੀ ਸ਼ੋਰ ਨਹੀਂ ਹੋਣਾ ਚਾਹੀਦਾ ਤਾਂ ਮੈਂ ਸਹੀ ਤਰੀਕੇ ਨਾਲ ਲਿਖ ਸਕਦੀ ਹਾਂ ਮੇਰਾ ਲਿਖਣ ਦਾ ਕੰਮ ਰੋਜ਼ ਦਾ ਹੈ ਮੈਂ ਰੋਜ਼ਾਨਾ ਲਿਖਦੀ ਹਾਂ ਹਰ ਹਰ ਵੇਲੇ ਜਦੋਂ ਮੈਨੂੰ ਟਾਈਮ ਲੱਗਦਾ ਹੈ ਤਾਂ ਮੈਂ ਲਿਖਣ ਦਾ ਕੰਮ ਹੀ ਕਰਦੀ ਹਾਂ ਮੈਨੂੰ ਸਾਫ ਸੁਥਰੀ ਜਗ੍ਹਾ 'ਤੇ ਬੈਠ ਕੇ ਲਿਖਣਾ ਪਸੰਦ ਹੈ ਇਸ ਲਈ ਮੈਂ ਇਹਨਾਂ ਆਦਤਾਂ ਦੀ ਪਾਲਣਾ ਕਰਦੀ ਹਾਂ ਲਿਖਣ ਵਾਲਾ ਕੰਮ ਸਾਨੂੰ ਅਨੁਸਾਰ ਸਾਨੂੰ ਅਨੁਸ਼ਾਸਨ 'ਚ ਰਹਿ ਕੇ ਕਰਨਾ ਚਾਹੀਦਾ ਹੈ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜਿਵੇਂ ਕੁਰਸੀ 'ਤੇ ਬੈਠ ਕੇ ਟੇਬਲ 'ਤੇ ਕਾਪੀ ਰੱਖ ਕੇ ਲਿਖਣਾ ਚਾਹੀਦਾ ਹੈ ਲਿਖਾਵਟ ਵਧੀਆ ਤਰੀਕੇ ਨਾਲ ਹੋਣੀ ਚਾਹੀਦੀ ਹੈ ਜਦੋਂ ਆਪਾਂ ਸਾਰੇ ਨਿਯਮਾਂ ਦੀ ਪਾਲਣਾ ਕਰਕੇ ਲਿਖਦੇ ਹਾਂ ਤਾਂ ਮਜ਼ੇਦਾਰ ਹੁੰਦਾ ਹੈ ਲਿਖਣਾ ਲਿਖਣ ਲਈ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ ਕਿ ਲਿਖਾਵਟ ਵਧੀਆ ਹੋਣੀ ਚਾਹੀਦੀ ਹੈ ਪੈਨ ਨੂੰ ਵਧੀਆ ਤਰੀਕੇ ਨਾਲ ਫੜਨਾ ਚਾਹੀਦਾ ਹੈ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ